ਸਤਿ ਸ਼੍ਰੀ ਅਕਾਲ ਮੈਂ ਕਾਰਤਿਕ ਬੋਲ ਰਿਹਾ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਨੂੰ ਸਾਈਕਲ ਚਲਾਉਣ ਦਾ ਬਹੁਤ ਸ਼ੌਂਕ ਹੈ ਮੇਰਾ ਮੈਨੂੰ ਸਾਰਿਆਂ ਨਾਲੋਂ ਪਹਿਲਾਂ ਸਾਈਕਲ ਮੇਰੇ ਪਾਪਾ ਨੇ ਲਿਆ ਕੇ ਦਿੱਤਾ ਸੀ ਜਦੋਂ ਕਿ ਮੈਂ ਸ਼ਾਇਦ ਅੱਠਵੀਂ 'ਚ ਸ਼ਾਇਦ ਸੱਤਵੀਂ 'ਚ ਹੁੰਦਾ ਸੀ ਔਰ ਸਾਈਕਲ ਚਲਾਉਣ ਦਾ ਬਹੁਤ ਹੀ ਆਨੰਦ ਆਉਂਦਾ ਹੈਗਾ ਸਾਈਕਲ ਚਲਾਉਣ ਦੇ ਫ਼ਾਇਦੇ ਬਹੁਤ ਆ ਸਾਈਕਲ ਚਲਾਉਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਸਾਨੂੰ ਰੋਜ਼ ਰੋਜ਼ਾਨਾ ਹੀ ਸਾਈਕਲ ਚਲਾਉਣਾ ਚਾਹੀਦਾ ਹੈ ਰੋਜ਼ ਦਾ ਦੋ ਤਿੰਨ ਕਿਲੋਮੀਟਰ ਤਾਂ ਸਾਨੂੰ ਚਲਾਉਣਾ ਹੀ ਚਾਹੀਦਾ ਨਾ ਕਿਉਂਕਿ ਸਾਈਕਲ ਚਲਾਉਣ ਨਾਲ ਸਾਡਾ ਸਰੀਰ ਦਾ ਮੋਟਾਪਾ ਨਹੀਂ ਵੱਧਦਾ ਔਰ ਸਾਨੂੰ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਇਸ ਦੇ ਨਾਲ ਸਾਡੀ ਸਾਹ ਦੀ ਪ੍ਰੋਬਲਮ ਵੀ ਅੱਛੀ ਰਹਿੰਦੀ ਹੈ ਸਾਈਕਲ ਚਲਾਉਣ ਨਾਲ ਸਾਈਕਲ ਦੇ ਬਹੁਤ ਜਿਆ ਬਹੁਤ ਹੀ ਜ਼ਿਆਦਾ ਫ਼ਾਇਦੇ ਹਨ ਸਾਈਕਲ ਚਲਾਉਣ ਨਾਲ ਸਾਡੇ ਅਸੀਂ ਸਾਈਕਲ ਦਾ ਕੋਈ ਖਰਚਾ ਵੀ ਨਹੀਂ ਹੈ ਸਾਈਕਲ 'ਤੇ ਅਸੀਂ ਦੂਰ ਦੂਰ ਵੀ ਜਾ ਸਕਦੇ ਹਾਂ ਔਰ ਨਾ ਹੀ ਇਸ ਦਾ ਚਲਾਨ ਹੋਣਾ ਕੋਈ ਨਾ ਇਸ ਦੇ ਵਿੱਚ ਤੇਲ ਪੈਣਾ ਹੈਗਾ ਔਰ ਨਾ ਹੀ ਇਸ 'ਤੇ ਕੋਈ ਖਰਚਾ ਹੈ ਬਸ ਆਪਣੇ ਆਪਣੇ ਸਰੀਰ 'ਤੇ ਹੈ ਅਸੀਂ ਕੋਈ ਖਰਚ ਕੋਈ ਖਰਚ ਸਾਈਕਲ 'ਤੇ ਫਾਲਤੂ ਦਾ ਖਰਚ ਨਹੀਂ ਹੈਗਾ ਸਾਈਕਲ 'ਤੇ ਸਾਨੂੰ ਬਸ ਸਾਈਕਲ ਚਲਾਉਣਾ ਰੋਜ਼ਾਨਾ ਚਲਾਉਣਾ ਚਾਹੀਦਾ ਹੈ ਸਾਈਕਲ ਚਲਾਉਣਾ ਨਾਲ ਅਸੀਂ ਕਾਫ਼ੀ ਫਿਟ ਰਹਿੰਦੇ ਹਾਂ ਔਰ ਵੀ ਸਾਨੂੰ ਸਾਈਕਲ ਦੇ ਕਾਫ਼ੀ ਫ਼ਾਇਦੇ ਹਨ ਧੰਨਵਾਦ